ਹੈਲੋ ਹਾਂਜੀ ਫਰਨੀਚਰ ਤੋਂ ਗੱਲ ਕਰ ਰਹੇ ਆ ਹਾਂਜੀ ਸਰ ਮਿਲ ਜਾਏਗਾ ਜੀ ਹਾਂਜੀ ਪੰਜਾਹ ਹਜ਼ਾਰ ਤੋਂ ਸਟਾਰਟਿੰਗ ਹੈ ਸਰ ਸਰ ਦੋਨੋਂ ਹੈਗੇ ਆ ਸਾਡੇ ਕੋਲ ਹਾਂਜੀ ਹਾਂਜੀ ਉਹ ਵੀ ਤੁਹਾਨੂੰ ਨਾਲ ਹੀ ਮਿਲ ਜਾਣਗੇ ਉਹਦੇ ਉਹਦੇ ਵਿੱਚ ਇਹ ਹੈ ਸਰ ਕਿ ਕੁਝ ਸੈੱਟ ਇੱਦਾਂ ਦੇ ਨੇ ਕਿ ਜਿਹਨਾਂ ਦੇ ਨਾਲ ਹੀ ਤੁਹਾਨੂੰ ਮਿਲ ਜਾਏਗੀ ਅਤੇ ਕੁਝ ਦੇ ਲਈ ਸਪੈਸ਼ਲ ਬਣਵਾਉਣਾ ਪਵੇਗਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਡਾਇਨਿੰਗ ਟੇਬਲ ਵੀ ਸਾਡੇ ਕੋਲ ਹੈਗੇ ਹੈ ਹਾਂਜੀ ਹਾਂਜੀ ਹਾਂਜੀ ਗਲਾਸ ਵਾਲੀ ਵੀ ਨੇ ਛੇ ਚੇਅਰ ਵਾਲੇ ਵੀ ਨੇ ਅਤੇ ਹੱਥ ਵਾਲੇ ਬਾਰ੍ਹਾਂ ਵਾਲੇ ਜਿੰਨੇ ਤੁਹਾਨੂੰ ਚਾਹੀਦੇ ਨੇ ਉਹਨਾਂ ਦਾ ਜੀ ਜੀ ਤੁਹਾਨੂੰ ਅੱਸੀ ਹਜ਼ਾਰ ਦੇ ਮਿਲ ਜਾਣਗੇ ਜਿਸ ਤਰ੍ਹਾਂ ਤੁਹਾਡੇ ਵੱਡਾ ਹੋਏਗਾ ਤਾਂ ਉਸ ਤਰ੍ਹਾਂ ਤੁਹਾਡਾ ਰੇਟ ਜ਼ਿਆਦਾ ਹੋਜੇਗਾ ਹਾਂਜੀ ਹਾਂਜੀ ਜਿੱਦਾਂ ਕੁਰਸੀਆਂ ਜ਼ਿਆਦਾ ਹੋਗੀਆਂ ਜਾਂ ਮਟੀਰੀਅਲ ਤੁਸੀਂ ਕਿਹੜਾ ਪਸੰਦ ਕਰ ਰਹੇ ਓਂ ਹਾਂਜੀ ਜੀ ਮਿਲ ਜਾਏਗਾ ਜੀ ਹਾਂਜੀ ਜ਼ਰੂਰ ਸਰ ਓਕੇ ਜੀ